ਹਾਂਜੀ ਸਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਜੋਤ ਆ ਜੀ ਮੈਂ ਕੁਛ ਦਿਨ ਪਹਿਲਾਂ ਹੀ ਕੈਬ ਬੁੱਕ ਕਰੀ ਸੀਗੀ ਪੀ ਬੀ ਪੈਂਹਠ ਮੋਹਾਲੀ ਤਿੰਨ ਜ਼ੀਰੋਆਂ ਪਿੱਛੇ ਅੱਠ ਇਹ ਸੀਗਾ ਗੱਡੀ ਦਾ ਨੰਬਰ ਜੋ ਮੈਂ ਬੁੱਕ ਕੀਤੀ ਸੀ ਆਪਣੀ ਕੈਬ ਇਹ ਮੈਂ ਕੈਬ ਪਟਿਆਲੇ ਤੋਂ ਲੁਧਿਆਣੇ ਜਾਣ ਲਈ ਬੁੱਕ ਕੀਤੀ ਸੀਗੀ ਅਤੇ ਇਸ ਵਿੱਚ ਮੈਂ ਸਫ਼ਰ ਦੇ ਵਿੱਚ ਮੇਰਾ ਸਮਾਨ ਸੀਗਾ ਮੇਰੇ ਨਾਲ ਮੇਰਾ ਬੈਗ ਸੀਗਾ ਅਤੇ ਬੈਗ ਦੇ ਵਿੱਚ ਮੇਰੇ ਡੋਕੂਮੈਂਟ ਸੀਗੇ ਮੇਰਾ ਪਰਸ ਸੀਗਾ ਮੇਰੇ ਹੋਰ ਆਪਣੇ ਪਰਸਨਲ ਆਈਡੈਂਟੀਫਿਕੇਸ਼ਨ ਕਾਰਡ ਵਗੈਰਾ ਸੀਗੇ ਅਤੇ ਉਹ ਸਾਰਾ ਕੁਝ ਮੇਰਾ ਕ ਕੈਸ਼ ਮਨੀ ਵਗੈਰਾ ਸਾਰਾ ਕੁਛ ਬੈਗ ਦੇ ਅੰਦਰ ਸੀਗਾ ਅਤੇ ਸਫ਼ਰ ਦੇ ਦੌਰਾਨ ਮੈਂ ਉਹ ਆਪਣਾ ਜੋ ਬੈਗ ਹੈ ਮੈਂ ਉਹ ਗੱਡੀ ਵਿੱਚ ਭੁੱਲ ਗਿਆ ਅਤੇ ਉਹ ਹੁਣ ਬੈਗ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਅਤੇ ਮੈਂ ਤੁਹਾਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਹਾਂ ਵੀ ਸਰ ਵੀ ਤੁਸੀਂ ਇਹ ਦੁਬਾਰਾ ਆ ਕੇ ਮੈਨੂੰ ਬੈਗ ਦੇ ਦਿਉ ਵੀ ਇਹ ਜੋ ਵੀ ਤੁਹਾਡੀ ਖੇਚਲ ਹੈ ਜੋ ਵੀ ਪ੍ਰੋਬਲਮ ਹੈ ਇਸ ਲਈ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਵੀ ਤੁਹਾਨੂੰ ਇੰਨੀ ਖੇਚਲ ਕਰਨੀ ਪੈ ਰਹੀ ਹੈ ਵੀ ਤੁਸੀਂ ਇੰਨੀ ਦੂਰੋਂ ਫਿਰ ਵਾਪਸ ਆਓਗੇ ਮੇਰਾ ਬੈਗ ਦੇਣ ਅਤੇ ਉਹ ਮੈਂ ਤੁਹਾਨੂੰ ਉਸਦੇ ਅਲੱਗ ਪੈਸੇ ਦੇ ਦੂੰਗਾ ਬਟ ਜੋ ਮੇਰਾ ਬੈਗ ਆ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਆ ਉਹਦੇ ਵਿੱਚ ਮੇਰਾ ਬਹੁਤ ਸਾਰਾ ਡਾਟਾ ਬਹੁਤ ਸਾਰਾ ਸਮਾਨ ਹੈ ਅਤੇ ਪਲੀਜ਼ ਸਰ ਵੀ ਮੈਂ ਇਹੀ ਰਿਕੁਐਸਟ ਕਰਨਾ ਚਾਹੂੰਗਾ ਵੀ ਤੁਸੀਂ ਇੱਕ ਵਾਰੀ ਆ ਕੇ ਅਤੇ ਮੈਨੂੰ ਦੁਬਾਰਾ ਮੈਨੂੰ ਫੜ੍ਹਾ ਦਿਉ ਅਤੇ ਜੋ ਵੀ ਆਪਣੇ ਐਕਸਟ੍ਰਾ ਚਾਰਜਿਸ ਹੋਣਗੇ ਮੈਂ ਤੁਹਾਨੂੰ ਦੇ ਦੂੰਗਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਊਂਗਾ ਤੁਸੀਂ ਇੱਕ ਵਾਰ ਮੈਨੂੰ ਵਾਪਸ ਆ ਕੇ ਦੇ ਅਤੇ ਅ ਜੋ ਵੀ ਪੇਮੈਂਟ ਹੈ ਮੈਂ ਤੁਹਾਨੂੰ ਉਹ ਵਾ ਉਹ ਕਰ ਦੂੰਗਾ ਉਹਦੀ ਅਡਵਾਂਸ ਦੇ ਵਿੱਚ ਥੈਂਕ ਯੂ ਸਰ